ਮੈਨੂੰ ਇੱਕ ਕਿਤਾਬ ਨੂੰ ਪੂਰਾ ਪੜ੍ਹਨ 'ਚ ਇੱਕ ਜਾਂ ਦੋ ਮਹੀਨੇ ਲੱਗ ਜਾਂਦੇ ਹਨ ਮੈਂ ਹਰ ਰੋਜ਼ ਇਸ ਨੂੰ ਇੱਕ ਜਾਂ ਦੋ ਘੰਟੇ ਵਿੱਚ ਪੜ੍ਹਦੀ ਹਾਂ ਗ ਜੇਕਰ ਮੈਨੂੰ ਛੁੱਟੀ ਹੋਵੇ ਤਾਂ ਮੈਂ ਕਦੇ ਕਦਾਈਂ ਇਸਨੂੰ ਤਿੰਨ ਜਾਂ ਚਾਰ ਘੰਟੇ ਵਿੱਚ ਪੜ੍ਹਦੀ ਹਾਂ ਮੈਨੂੰ ਕਿਤਾਬ ਪੜ੍ਹਨ ਦਾ ਬਹੁਤ ਸ਼ੌਂਕ ਹੈ ਕਦੇ ਕਦਾਈਂ ਮੈ ਇਸ ਨੂੰ ਹਫਤੇ ਵਿੱਚ ਇੱਕ ਜਾਂ ਦੋ ਨਾਵਲ ਪੜ੍ਹ ਲੈਂਦੀ ਹਾਂ